ਪੰਜਾਬ ਵਿੱਚ ਕਾਫੀ ਮੂਵੀ ਥੀਏਟਰ ਮਲਟੀਪਲੈਕਸ ਹਨ ਪੰਜਾਬ ਪੰਜਾਬ ਦੇ ਵਿੱਚ ਚੰਡੀਗੜ੍ਹ ਵਿੱਚ ਸਭ ਤੋਂ ਵੱਡਾ ਮੌਲ ਏਲਾਂਟੇ ਮਾਲ ਵਿੱਚ ਪੀ ਵੀ ਆਰ ਥੀਏਟਰ ਹੈ ਜੋ ਕਿ ਸਾਰੀ ਵਧੀਆ ਵਧੀਆ ਮੂਵੀਆਂ ਉੱਥੇ ਹੀ ਲੱਗਦੀਆਂ ਹਨ ਅਤੇ ਪੰਜਾਬ ਵਿੱਚ ਮੋਹਾਲੀ ਮੋਹਾਲੀ ਸ਼ਹਿਰ ਵਿੱਚ ਨੌਰਥ ਸਾਈਡ ਦਾ ਸਭ ਤੋਂ ਵੱਡਾ ਮਾਲ ਨੌਰਥ ਕੰਟਰੀ ਮਾਲ ਹੈ ਜਿਸ ਵਿੱਚ ਵੀ ਪੀ ਵੀ ਆਰ ਅਤੇ ਪੀ ਵੀ ਆਰ ਗੋਲਡ ਦੋ ਅਲੱਗ ਅਲੱਗ ਸਿਨੇਮਾ ਹਾਲ ਹਨ ਜਿਸ ਵਿੱਚ ਮੂਵੀਆਂ ਲੱਗਦੀਆਂ ਹਨ ਅਤੇ ਹੋਰ ਵੀ ਕਾਫੀ ਮੂਵੀ ਥੀਏਟਰ ਹਨ ਜਿਵੇਂ ਕਿ ਸੀਨੀਪਲੈਕਸ ਹੋ ਗਿਆ ਇੰਡੋ ਇੰਡੋਐਕਸ ਮਾਲ ਹੋ ਗਿਆ ਇਹ ਸਾਰੇ ਮਾਲ ਹਨ